ਹਰ ਮੌਸਮ ਵਿੱਚ ਸਾਡੇ ਖੇਤਰ ਦਾ ਮਾਹੌਲ ਵੀ ਵੱਖਰਾ ਵੱਖਰਾ ਹੁੰਦਾ ਹੈ ਜਿਵੇਂ ਸਾਡੇ ਨਜ਼ਦੀਕੀ ਖੇਤਰਾਂ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਸਰਦੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਬਰਸਾਤ ਬਹੁਤ ਘੱਟ ਪੈਂਦੀ ਹੈ ਜਿਸ ਨਾਲ ਸੁੱਕੀ ਗਰਮੀ ਅਤੇ ਸੁੱਕੀ ਸਰਦੀ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ ਜਿਸ ਨਾਲ ਲੋਕ ਕਾਫੀ ਬਿਮਾਰ ਹੁੰਦੇ ਹਨ ਸਾਡੇ ਨਜ਼ਦੀਕੀ ਖੇਤਰਾਂ ਵਿੱਚ ਗਰਮੀ ਦੇ ਮੌਸਮ ਵਿੱਚ ਲੂ ਵੀ ਚੱਲਦੀ ਹੈ ਜਿਸ ਨਾਲ ਕਾਫੀ ਲੋਕ ਪ੍ਰਭਾਵਿਤ ਹੁੰਦੇ ਹਨ ਇਸ ਕਰਕੇ ਪਿਛਲੇ ਕੁਝ ਸਾਲਾਂ 'ਚੋਂ ਮੈਂ ਇਹ ਅਨੁਭਵ ਕੀਤਾ ਹੈ ਕਿ ਗਰਮੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਗਲੋਬਲ ਵੋਰਮਿੰਗ ਵੱਧਦੀ ਜਾ ਰਹੀ ਹੈ ਕਿਉਂਕਿ ਅਸੀਂ ਮਨੁੱਖ ਪੇੜ ਕੱਟਦੇ ਜਾ ਰਹੇ ਹਾਂ ਇਸ ਕਾਰਨ ਸਾਡਾ ਜਿਹੜਾ ਵਾਤਾਵਰਨ ਹੈ ਉਹ ਡਿਸਟਰਬ ਹੋ ਰਿਹਾ ਅਤੇ ਗਲੋਬਲ ਵੋਰਮਿੰਗ ਹੋਣ ਦੇ ਕਾਰਨ ਪੇੜ ਨਾ ਹੋਣ ਦੇ ਕਾਰਨ ਗਰਮੀ ਅਤੇ ਸਰਦੀ ਬਹੁਤ ਹੋ ਰਹੀ ਹੈ ਧੰਨਵਾਦ